ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਡਾਕਟਰਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਰੀਜ਼ ਗੰਭੀਰ ਰੂਪ ਵਿੱਚ ਵੀ ਹੋਸਪਿਟਲ ਵਿੱਚ ਪਾਏ ਜਾਂਦੇ ਹਨ ਅਤੇ ਐਮਰਜੈਂਸੀ ਵਿੱਚ ਵੀ ਜਿਸ ਕਰਕੇ ਐਮਰਜੈਂਸੀ ਦੀਆਂ ਪੂਰੀਆਂ ਸੁਵਿਧਾਵਾਂ ਨਾ ਹੋਣ ਕਰਕੇ ਉਹਨਾਂ ਨੂੰ ਪੂਰਨ ਸੁਵਿਧਾ ਨਹੀਂ ਮਿਲਦੀਆਂ ਅਤੇ ਉਹਨਾਂ ਨੂੰ ਅੱਗੇ ਰੈਫਰ ਕੀਤਾ ਜਾਂਦਾ ਹੈ ਜਿਵੇਂ ਕਿ ਮੈਡੀਕਲ ਸਟੋਰ ਵਿੱਚ ਬਹੁਤ ਸਾਰੀਆਂ ਮੈਡੀਸਨ ਦਵਾਈਆਂ ਬਹੁਤ ਮਹਿੰਗੀਆਂ ਪਾਈਆਂ ਜਾਂਦੀਆਂ ਹਨ ਸਕੈਨਿੰਗ ਦੀ ਪੂਰੀ ਤਰ੍ਹਾਂ ਸੁਵਿਧਾ ਨਹੀਂ ਪਾਈ ਜਾਂਦੀ ਐਮਰਜੈਂਸੀ ਵਿੱਚ ਵੈਟੀਲੇਟਰ ਨਹੀਂ ਪਾਏ ਜਾਂਦੇ ਜਿਸ ਕਰਕੇ ਮਰੀਜ਼ਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਡਾਕਟਰਸ ਨੂੰ ਵੀ ਇਹਨਾਂ ਸਭ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਉਹ ਪੂਰੀਆਂ ਦਵਾਈਆਂ ਹੋਸਪਿਟਲ ਵਿੱਚ ਨਹੀਂ ਪਾਈ ਜਾਂਦੀਆਂ ਅਤੇ ਮਰੀਜ਼ਾਂ ਨੂੰ ਦਵਾਈਆਂ ਬਾਹਰੋਂ ਲੈਣੀਆਂ ਪੈਂਦੀਆਂ ਹਨ ਸਕੈਨਿੰਗਾ ਲਈ ਵੀ ਬਾਹਰ ਜਾਣਾ ਪੈਂਦਾ ਹੈ ਬਹੁਤ ਸਾਰੀਆਂ ਮੁਸ਼ਕਿਲਾਂ ਜਿਵੇਂ ਪਾਈਆਂ ਜਾਂਦੀਆਂ ਹਨ ਧੰਨਵਾਦ